ਪੰਜਾਬੀ ਦੇ ਉੱਘੇ ਹਾਸ ਰਸ ਕਵੀ ਚਰਨ ਸਿੰਘ ਸ਼ਹੀਦ ਹਨ ਅਤੇ ਇਹਨਾਂ ਨੂੰ ਇੱਕ ਹਾਸ ਰਸ ਕਵੀ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈ ਇਹਨਾਂ ਦੀਆਂ ਮੁੱਖ ਕਿਤਾਬਾਂ ਹੱਸਦੇ ਹੰਝੂ ਦਲੇਰ ਕੌਰ ਰਣਜੀਤ ਕੌਰ ਚੰਚਲ ਮੂਰਤੀ ਅਤੇ ਦੋ ਵਹੁਟੀਆਂ ਹਨ ਅਤੇ ਇਹਨਾਂ ਦੀ ਜਿਹੜੀ ਦੋ ਵਹੁਟੀਆਂ ਕਿਤਾਬ ਹੈ ਇਹ ਮੈਂ ਜਦੋਂ ਪੜ੍ਹੀ ਤਾਂ ਮੈਨੂੰ ਬਹੁਤ ਹੀ ਪੜ੍ਹ ਕੇ ਬਹੁਤ ਹੀ ਜ਼ਿਆਦਾ ਹਾਸਾ ਆਇਆ ਹੱਸਣ ਲਈ ਮਜ਼ਬੂਰ ਕੀਤਾ ਮੈਨੂੰ ਇਸ ਕਿਤਾਬ ਨੇ ਕਿਉਂਕਿ ਇਸਦੇ ਵਿੱਚ ਦੋ ਵਹੁਟੀਆਂ ਦੀ ਜਿਹੜੀ ਆਪਸੀ ਨੋਕ ਝੋਕ ਸੀ ਆਪਣੇ ਪਤੀ ਦੇ ਬਾਰੇ ਜਿਹੜੀਆਂ ਉਹ ਗੱਲਾਂ ਕਰਦੀਆਂ ਸੀ ਤਾਂ ਉਹ ਇੰਨੀ ਕੁ ਹਸਾਉਣ ਵਾਲੀ ਸੀ ਕਿ ਉਹਨਾਂ ਨੇ ਆਪਣੀ ਇਹ ਪਤੀ ਦੇ ਬਾਰੇ ਕੀਤੀ ਹੋਈ ਨੋਕ ਝੋਕ ਨੂੰ ਇਹਦੇ ਰਾਹੀਂ ਹੀ ਉਹਨਾਂ ਨੇ ਆਪਣੀ ਬੜੇ ਹਾਸੇ ਦੇ ਵਿੱਚ ਆਪਣੀ ਜ਼ਿੰਦਗੀ ਦੀ ਅਸਲੀਅਤ ਨੂੰ ਉਹਨਾਂ ਨੇ ਬਿਆਨ ਕੀਤਾ ਸੀ ਆਪਣੇ ਇਹ ਆਪਸੀ ਵਾਰਤਾਲਾਪਾ ਦੇ ਰਾਹੀਂ ਹੀ ਅਤੇ ਇਸ ਕਰਕੇ ਕਿਤਾਬਾਂ ਭਾਵੇਂ ਬੜੀ ਸਿੰਪਲ ਸੀ ਪਰ ਇਹ ਇਹਨੇ ਆਪਣੀ ਸਿੰਪਲੀਸਿਟੀ ਦੇ ਨਾਲ ਨਾਲ ਇਸ ਲਈ ਇਸ ਜ਼ਿੰਦਗੀ ਦੀ ਅਸਲੀਅਤ ਨੂੰ ਬਿਆਨ ਕੀਤਾ